ਭੰਗੜਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਪੰਜਾਬੀਆਂ ਦੇ ਦਿਲਾਂ ਦੇ ਵਿਚ ਇਸ ਤਰ੍ਹਾਂ ਵਸਿਆ ਹੋਇਆ ਹੈ ਕਿ ਭੰਗੜੇ ਤੋਂ ਬਿਨਾਂ ਉਹਨਾਂ ਨੂੰ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਸਫਲ ਨਜ਼ਰ ਨਹੀਂ ਆਉਂਦਾ ਭੰਗੜਾ ਪੰਜਾਬ ਦੇ ਵਿੱਚ ਹਰ ਇੱਕ ਬੱਚੇ ਬੱਚੇ ਨੂੰ ਪਾਉਣਾ ਆਉਂਦਾ ਹੈ ਅਤੇ ਉਹ ਇਸ ਤੋਂ ਜਾਣੂ ਹੁੰਦਾ ਹੈ ਭੰਗੜਾ ਇੱਕ ਖੁਸ਼ੀ ਮਨਾਉਣ ਦਾ ਬੜਾ ਵਧੀਆ ਢੰਗ ਹੈ ਉਸਦੇ ਨਾਲ ਹੀ ਇਹ ਕਸਰਤ ਦਾ ਵੀ ਇੱਕ ਬਹੁਤ ਵਧੀਆ ਸਰੋਤ ਹੈ ਲਗਭਗ ਅੱਧਾ ਘੰਟਾ ਜਾਂ ਇੱਕ ਘੰਟਾ ਭੰਗੜਾ ਪਾ ਕੇ ਪੂਰੇ ਸਰੀਰ ਦੀ ਵਧੀਆ ਕਸਰਤ ਹੋ ਜਾਂਦੀ ਹੈ ਅੱਜ ਦੇ ਟਾਈਮ ਦੇ ਵਿੱਚ ਭੰਗੜਾ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਹੈ ਭੰਗੜੇ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਨਾਚ ਜਿਸ ਤਰ੍ਹਾਂ ਲੁੱਡੀ ਤੁਣਕਾ ਅਤੇ ਖੁੱਲ੍ਹਾ ਭੰਗੜਾ ਮੌਜੂਦ ਹਨ ਅੱਜ ਕੱਲ੍ਹ ਭੰਗੜੇ ਦੇ ਵਿੱਚ ਬਹੁਤ ਨਵੇਂ ਯੁੱਗ ਤਕਨੀਕਾਂ ਅਤੇ ਨਵੇਂ ਨਾਮ ਆ ਗਏ ਹਨ ਹਰੇਕ ਪ੍ਰੋਗਰਾਮ ਭੰਗੜੇ ਤੋਂ ਬਿਨਾਂ ਵਧੀਆ ਜਾਂ ਸਫਲ ਹੁੰਦਾ ਨਜ਼ਰ ਨਹੀਂ ਆਉਂਦਾ ਸਕੂਲਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਭੰਗੜੇ ਦੇ ਕੰਪੀਟੀਸ਼ਨ ਅਤੇ ਉਹਨਾਂ ਦੀਆਂ ਤਿਆਰੀਆਂ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਹੁੰਦੀਆਂ ਹਨ ਅੱਜ ਕੱਲ੍ਹ ਯੋਗਾ ਗਰਾਊਂਡ ਦੇ ਵਿੱਚ ਵੀ ਲੋਕ ਅਕਸਰ ਭੰਗੜੇ ਦੇ ਅਭਿਆਸ ਕਰਦੇ ਹਨ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਭੰਗੜੇ ਦਾ ਉਪਯੋਗ ਕਰਦੇ ਹਨ ਸਾਨੂੰ ਭੰਗੜਾ ਬਚਪਨ ਦੇ ਵਿੱਚ ਹੀ ਸਕੂਲਾਂ ਕਾਲਜਾਂ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਅਤੇ ਹੁਣ ਅਸੀਂ ਅਲੱਗ ਅਲੱਗ ਜਗ੍ਹਾ ਦੇ ਉੱਪਰ ਜਾ ਕੇ ਬੱਚਿਆਂ ਨੂੰ ਭੰਗੜਾ ਸਿਖਾ ਰਹੇ ਹਾਂ ਪਰ ਹੁਣ ਇਹ ਭੰਗੜਾ ਖੇਡਾਂ ਸਕੂਲਾਂ ਕਾਲਜਾਂ ਸਭ ਕਿਤੇ ਮਸ਼ਹੂਰ ਹੈ ਅਤੇ ਪੂਰੇ ਦੁਨੀਆਂ ਦੇ ਲੋਕ ਭੰਗੜੇ ਤੋਂ ਜਾਣੂ ਹਨ